ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਆਪਾਂ ਪੇਂਟਿੰਗ ਦੇ ਸਕਦੇ ਹਾਂ ਜਿਵੇਂ ਕਿ ਗੈਲਰੀਆਂ ਮਿਊਜ਼ੀਅਮ ਇਸ ਤੋਂ ਇਲਾਵਾ ਆਪਾਂ ਟੈਕਨੋਲੋਜੀ ਆਉਣ ਦੇ ਨਾਲ ਆਪਣਾ ਇੰਟਰਨੈਟ ਦੀ ਸਹਾਇਤਾ ਨਾਲ ਵੀ ਪੇਂਟਿੰਗ ਨੂੰ ਦੇਖ ਸਕਦੇ ਹਾਂ ਪੇਂਟਿੰਗ ਆਪਣੇ ਦਿਲ ਦੇ ਗੱਲਾਂ ਨੂੰ ਪ੍ਰਗਟ ਕਰਦੀ ਹੈ ਮਤਲਬ ਆਪਾਂ ਜੋ ਗੱਲਾਂ ਬੋਲ ਕੇ ਨਹੀਂ ਦੱਸ ਸਕਦੇ ਕਈ ਪੇਂਟਿੰਗਾਂ ਇਹੋ ਜਿਹੀਆਂ ਹੁੰਦੀਆਂ ਡੀ ਪੇਂਟਿੰਗਾਂ ਮਤਲਬ ਜਿਵੇਂ ਜਿਨ੍ਹਾਂ ਦਾ ਬਹੁਤ ਗਹਿਰਾ ਵੀ ਮਤਲਬ ਹੁੰਦਾ ਵੀ ਆਪਾਂ ਆਮ ਬੰਦੇ ਨਹੀਂ ਸਮਝ ਸਕਦੇ ਅਤੇ ਉਹਨਾਂ ਨੂੰ ਜਿਵੇਂ ਕੋਈ ਕਲਾ ਵਾਲਾ ਹੀ ਸਮਝ ਸਕਦਾ ਇਹੋ ਜਿਹੀਆਂ ਜਿਹੜੀਆਂ ਡੀਪ ਪੇਂਟਿੰਗਾਂ ਹੁੰਦੀਆਂ ਉਹਨਾਂ ਨੂੰ ਖਰੀਦਿਆ ਅਤੇ ਵੇਚਿਆ ਵੀ ਜਾ ਸਕਦਾ ਇਹਨਾਂ ਨੂੰ ਖਰੀਦਣ ਵੇਚਣ ਵਾਸਤੇ ਜਿਵੇਂ ਨਿਲਾਮੀਆਂ ਵੀ ਹੁੰਦੀਆਂ ਹੁਣ ਜਿਵੇਂ ਇੰਟਰਨੈਟ ਦਾ ਜ਼ਮਾਨਾ ਜਿਹਾ ਹੈਗਾ ਜਿਵੇਂ ਕਈ ਵਾਰੀ ਲੋਕ ਪੋਸਟਾਂ ਪਾ ਦਿੰਦੇ ਹੈਗੇ ਆ ਵੀ ਜਿਵੇਂ ਅਤੇ ਉਹ ਹਰ ਇੱਕ ਮਤਲਬ ਥਾਂ 'ਤੇ ਪਹੁੰਚ ਜਾਂਦੀ ਹੈ ਹਰ ਇੱਕ ਨੂੰ ਮੈਸੇਜ ਚਲਾ ਜਾਂਦਾ ਹੈਗਾ ਅਤੇ ਵੀ ਜਿਹੜਾ ਜਿਹੜਾ ਇਹਨਾਂ ਪੇਂਟਿੰਗਾਂ ਦਾ ਲੈਣ ਵਾਸਤੇ ਇੰਟਰਸਟਡ ਹੁੰਦਾ ਜਿਵੇਂ ਉਹ ਥਾਂ ਮਤਲਬ ਫਿਕਸ ਕਰ ਦੇ ਕਰ ਦਿੰਦੇ ਆ ਮਤਲਬ ਤਾਂ ਉਹ ਉਸ ਥਾਂ 'ਤੇ ਆਪਣੇ ਆਪ ਹੀ ਚਲੇ ਜਾਂਦੇ ਆ ਨਿਲਾਮੀ ਵਾਲੀ ਜਗ੍ਹਾ 'ਤੇ ਅਤੇ ਉੱਥੇ ਜਿਵੇਂ ਨਿਲਾਮੀ ਹੁੰਦੀ ਹੈ ਜਿਵੇਂ ਹੁਣ ਇੱਕੋ ਹੀ ਪੇਂਟਿੰਗ ਜਿਹੜੀਆਂ ਵੀ ਜਿਵੇਂ ਪਿੰਡ ਇੱਕ ਪੇਂਟਿੰਗ ਦਾ ਵੀ ਮੁੱਲ ਰੱਖਤਾ ਅਗਲਿਆਂ ਨੇ ਵੀ ਐਗਜਾਮਪਲ ਤੌਰ 'ਤੇ ਜਿਵੇਂ ਲੱਖ ਰੁਪਈਆ ਰੱਖਤਾ ਲੱਖ ਤਾਂ ਹੈਗਾ ਹੁਣ ਜਿਹੜਾ ਜਣਾ ਮਤਲਬ ਉਸ ਤੋਂ ਵੱਧ ਬੋਲੀ ਦੇਊਗਾ ਅਤੇ ਉਸ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਮਤਲਬ ਮਤਲਬ ਇਵੇਂ ਵੀ ਉਹ ਵੀ ਜਿਵੇਂ ਬੋਲੀ 'ਤੇ ਬੋਲੀ ਨੂੰ ਵੀ ਵਧਾਈ ਜਾਂਦੇ ਲੱਖ ਤੋਂ ਜਿਵੇਂ ਵਧਾਈ ਜਾਂਦੇ ਆ ਉਹ ਵਧਾਉਣ ਦੇ ਕਾਰਨ ਕਿੰਨਾ ਹੈਗਾ ਜਿਵੇਂ ਉਹ ਵੀ ਜਦੋਂ ਵੀ ਇੱਕ ਦੋ ਜਾਂ ਤਿੰਨ ਜਿਵੇਂ ਜਿੱਦਾਂ ਨ ਨਿਲਾਮੀ ਦਾ ਪ੍ਰੋਸੈਸ ਜਿਹਾ ਹੁੰਦਾ ਵੀ ਉਵੇਂ ਜਦੋਂ ਅਗਲਾ ਇੱਦਾਂ ਕਰਦਾ ਵੀ ਤਿੰਨ 'ਤੇ ਆ ਕੇ ਜੇ ਨੀ ਜਿੰਨੀ ਰਕਮ ਰੁੱਕ ਜਾਂਦੀ ਲੱਖ ਤੋਂ ਵੱਧ ਜਿੰਨਾ ਵੀ ਉਹ ਪੇਂਟਿੰਗ ਉਸ ਬੰਦੇ ਦੀ ਹੋ ਜਾਂਦੀ ਹੈ ਇੱਦਾਂ ਹੀ ਮਤਲਬ ਇਸ ਕ ਇਵੇਂ ਕਈ ਵਾਰੀ ਤਾਂ ਨਿਲਾਮੀਆਂ ਜਿਵੇਂ ਆਨਲਾਈਨ ਵੀ ਹੁੰਦੀਆਂ ਇੱਦਾਂ ਵੀ ਕਿਨਮ ਹੈਗੇ ਇੱਦਾਂ ਉਹ ਨਿਲਾਮੀਆਂ ਦਾ ਪ੍ਰੋਸੈਸ ਵੀ ਇੱਦਾਂ ਹੀ ਹੁੰਦਾ ਮਤਲਬ ਇਹ ਇਸ ਹਿਸਾਬ ਨਾਲ ਮਤਲਬ ਨਿਲਾਮੀਆਂ ਵੀ ਮਤਲਬ ਹੁੰਦੀਆਂ ਹੈਗੀਆਂ